ਮੇਰੇ ਕੋਲ ਬੁਣਾਈ ਨਾਲ ਕੋਈ ਸੰਬੰਧਿਤ ਟੀਚੇ ਜਾਂ ਇੱਛਾਵਾਂ ਤਾਂ ਨਹੀਂ ਹਨ ਪਰ ਮੈਨੂੰ ਬੁਣਾਈ 'ਤੇ ਸ ਕਰਨੀ ਚੰਗੀ ਲੱਗਦੀ ਮੈਂ ਆਪਣੇ ਬੱਚਿਆਂ ਨੂੰ ਆਪਣੇ ਪੋਤੇ ਪੋਤੀਆਂ ਨੂੰ ਆਪਣੇ ਭੈਣ ਭਰਾਵਾਂ ਦੇ ਬੱਚਿਆਂ ਨੂੰ ਬੁਣ ਕੇ ਜ਼ਰੂਰ ਦਿੰਦੀ ਹਾਂ ਮੈਨੂੰ ਇਹ ਚੰਗਾ ਲੱਗਦਾ ਬੁਣਾਈ ਕਰਨਾ ਇਹਦੇ ਨਾਲ ਸੰਬੰਧਿਤ ਮੈਨੂੰ ਕੋਈ ਟੀਚੇ ਤਾਂ ਨਹੀਂ ਨੇ ਬਸ ਮੇਰਾ ਇੱਕ ਸ਼ੌਕ ਹੈ ਮੈਂ ਇਸ ਕਰਕੇ ਬੁਣ ਲੈਂਦੀ ਹਾਂ ਮੈਂ ਆਪਣੀ ਮੰਮੀ ਕੋਲੋ ਸਿੱਖਿਆ ਸੀਗਾ ਉਸ ਤੋਂ ਬਾਅਦ ਬਸ ਮੈ ਮੈਨੂੰ ਸ਼ੌ ਸ਼ੌਕ ਹੈ ਮੇਰਾ ਕੋਈ ਟੀਚਾ ਨਹੀਂ ਹੈਗਾ